ਪੰਜਾਬੀ ਭਾਸ਼ਾ ਜਿਹੜੀ ਹੈ ਓਹ ਸਥਾਨਕ ਆਰਥਿਕਤਾ ਤੋਂ ਬਹੁਤ ਮਹੱਤਵਪੂਰਨ ਆਪਣਾ ਰੋਲ ਅਦਾ ਕਰਦੀ ਹੈ ਹੁਣ ਜਿਵੇਂ ਕਿਤੇ ਕਿਸੇ ਵੀ ਚੀਜ਼ ਦੀ ਲੈਣ ਦੇਣ ਹੈ ਹੈ ਨਾ ਉਹਦੇ ਵਿੱਚ ਜਦ ਆਪਾਂ ਆਮ ਆਪਾਂ ਪੰਜਾਬੀ ਭਾਸ਼ਾ ਵਰਤਦੇ ਹਾਂ ਆਮ ਕਿਸਾਨ ਬੰਦੇ ਨੂੰ ਨਾ ਵਪਾਰੀ ਬੰਦੇ ਨੂੰ ਸੌਖਾ ਹੋ ਜਾਂਦਾ ਸਮਝਣਾ ਜਦ ਫਿਰ ਜੇ ਅਸੀਂ ਹੋਰ ਹੋਰ ਲੈਂਗੂਏਜ ਯੂਜ਼ ਕਰੀ ਜਾਵਾਂਗੇ ਜਿਵੇਂ ਅੰਗਰੇਜ਼ੀ ਕਰੀਏ ਫਿਰ ਉਹਨਾਂ ਨੂੰ ਸਮਝ ਆਉਣੀ ਆ ਜਾਂ ਹਿੰਦੀ ਕਰੀ ਜਾਈਏ ਓਹੀ ਅੱਖਰ ਲੱਭੀ ਜਾਣਗੇ ਇਸ ਲਈ ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੁੰਦੇ ਹੋਏ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨੂੰ ਗੱਲਬਾਤ ਕਰਨ ਤਾਂ ਸਮਝਣੀ ਸੌਖੀ ਹੈ ਇਸ ਲਈ ਜੇ ਅਸੀਂ ਹੋਰ ਭਾਸ਼ਾ ਬੋਲੀਏ ਮੈਂ ਮੰਨ ਲਾਂ ਅੰਗਰੇਜ਼ੀ ਬੋਲੀ ਜਾਵਾਂ ਹੈਂ ਦੂਜਾ ਪੰਜਾਬੀ ਵਿਚਾਰਾ ਸਮਝ ਹੀ ਨਾ ਪਾਵੇ ਹੁਣ ਟਾਈਮ ਤਾਂ ਲੱਗੇਗਾ ਲੈਣ ਦੇਣ 'ਚ ਹੈਂ ਪਹਿਲੇ ਨਾ ਚੀਜ਼ ਦੀ ਕੁਆਲਿਟੀ ਪਤਾ ਲੱਗਣੀ ਹੈ ਕੀ ਕਹੀ ਜਾਂਦੇ ਇਸ ਲਈ ਪੰਜਾਬੀ ਭਾਸ਼ਾ 'ਚ ਜਦ ਅਸੀਂ ਗੱਲ ਕਰਦੇ ਹਾਂ ਤਾਂ ਲੈਣ ਦੈਣ ਹੈ ਨਾ ਮੇਲ ਜੋਲ ਸਾਡਾ ਵੱਧਦਾ ਆ ਸੌਖਾ ਹੁੰਦਾ ਇੱਕੋ ਭਾਸ਼ਾ ਦੇ ਬੰਦਿਆਂ ਨੂੰ ਮਿਲਣਾ ਚੰਗਾ ਲੱਗਦਾ ਨਾ ਠੀਕ ਇਸੇ ਤਰ੍ਹਾਂ ਜਦ ਅਸੀਂ ਆਰਥਿਕ ਤੌਰ 'ਤੇ ਵੀ ਸਾਨੂੰ ਮਜਬੂਤੀ ਮਿਲ ਜਾਂਦੀ ਹੈ ਕਿਉਂਕਿ ਸਾਡਾ ਲੈਣ ਦੇਣ ਸੌਖਾ ਹੋ ਜਾਂਦਾ ਹੈ ਸਾਨੂੰ ਅਮਾਊਂਟ ਪਤਾ ਹੁੰਦੀ ਏ ਕਿੰਨੀ ਆ ਕੁਆਲਿਟੀ ਕੀ ਆ ਉਹ ਸਾਰੀ ਚੀਜ਼ਾਂ ਸਾਨੂੰ ਸਮਝ ਆ ਜਾਂਦੀਆਂ ਔ ਅੱਖਰਾਂ ਦੇ ਨਾਲ ਤਾਂ ਇਸ ਕਰਕੇ ਸਾਡੀ ਸਥਾਨਕ ਆਰਥਿਕਤਾ ਦਾ ਇੱਦਾਂ ਵਿਕਾਸ ਹੁੰਦਾ ਆ